ਹਾਂ ਵਧੀਆ ਵਧੀਆ ਮਨਦੀਪ ਤੁਸੀਂ ਦੱਸੋ ਕੁਛ ਨਹੀਂ ਯਾਰ ਜੋਬ ਇੱਥੇ ਹੀ ਤਰਨ ਤਾਰਨ ਹੀ ਹਮ ਹਮ ਹਾਂ ਹਾਂ ਹਾਂ ਹਾਂ ਕਿਉਂ ਨਹੀਂ ਕਰ ਲੈਂਦੇ ਹਾਂ ਸ਼ੁਰੂ ਫਿਰ ਕੀ ਆ ਹਾਂ ਮੈਨੂੰ ਵੀ ਖੁਦ ਹੈਗਾ ਏ ਆ ਬਟ ਮੈਂ ਉਹ ਟ੍ਰੇਨਿੰਗ ਕਰਕੇ ਉਹਦੇ ਇਸੇ ਜੋਬ ਕਰਕੇ ਫਿਰ ਮੈਂ ਅੱਗੋਂ ਕਰ ਨਹੀਂ ਰਹੀ ਹਜੇ ਕਿ ਫਿਰ ਟਾਈਮ ਨਹੀਂ ਮਿਲਦਾ ਸਾਰਾ ਦਿਨ ਉੱਥੇ ਚ ਲੱਗ ਜਾਂਦਾ ਏ ਆ ਟਾਈਮ ਨਹੀਂ ਮਿਲ ਰਿਹਾ ਹਾਂ ਹਾਂ ਮੈਂ ਕਰਦੀ ਹਾਂ ਹਾਂ ਕੋਈ ਗੱਲ ਨਹੀਂ ਆਹ ਪਹਿਲਾਂ ਸੈਟਅਪ ਕਰ ਲਈਏ ਸਾਰਾ ਕੁਛ ਫਿਰ ਰੈਡੀ ਕਰ ਲਈਏ ਸਭ ਕੁਛ ਅਤੇ ਫਿਰ ਕਰਦੇ ਹਾਂ ਠੀਕ ਹੈ ਹਾਂ ਹਾਂ ਬਸ ਵਧੀਆ ਚਲ ਓਕੇ ਓਕੇ